ਡਾਂਸ ਵਿੱਚ ਸੱਭਿਆਚਾਰਕ ਭਾੜੇ ਨੂੰ ਦੂਰ ਕਰਨ ਅਤੇ ਲੋਕਾਂ ਨੂੰ ਇਕੱਠੇ ਲਿਆਉਣ ਦੀ ਸ਼ਕਤੀ ਹੈ ਅਤੇ ਹਾਂ ਇਹ ਬਿਲਕੁਲ ਸੱਚ ਹੈ ਮੈਂ ਇਹ ਤੁਹਾਨੂੰ ਇੱਕ ਐਗਜੈਂਪਲ ਦੇ ਨਾਲ ਸਮਝਾਉਂਦੀ ਹਾਂ ਜਿਵੇਂ ਕਿ ਪੰਜਾਬ ਦੇ ਵਿੱਚ ਬਹੁਤ ਸਾਰੇ ਡਾਂਸ ਹੁੰਦੇ ਹਨ ਇਹਨਾਂ ਵਿੱਚ ਜਿਵੇਂ ਭੰਗੜਾ ਮੁੰਡਿਆਂ ਦਾ ਭੰਗੜਾ ਕੁੜੀਆਂ ਦਾ ਗਿੱਧਾ ਅਤੇ ਕੁੜੀਆਂ ਵੀ ਭੰਗੜੇ ਵਿੱਚ ਸ਼ਾਮਿਲ ਹੁੰਦੀਆਂ ਹਨ ਇਹ ਡਾਂਸ ਬਹੁਤ ਜ਼ਿਆਦਾ ਸਹਾਇਕ ਹੁੰਦੇ ਹਨ ਲੋਕਾਂ ਨੂੰ ਆਪਣਾ ਮਾਇੰਡ ਨੂੰ ਫਰੈਸ਼ ਕਰਨ ਵਾਸਤੇ ਲੋਕ ਜਦੋਂ ਭੰਗੜੇ ਦੀ ਇਕੱਠੀ ਪ੍ਰੈਕਟਿਸ ਕਰਦੇ ਹਨ ਅਤੇ ਉਹਨਾਂ ਦੇ ਰਿਸ਼ਤੇ ਵੀ ਬਹੁਤ ਵਧੀਆ ਹੋ ਜਾਂਦੇ ਹਨ ਮਿਲ ਕੇ ਜਦੋਂ ਉਹ ਨਾ ਡਾਂਸ ਕਰਦੇ ਹਨ ਜਾਂ ਭੰਗੜਾ ਕਰਦੇ ਹਨ ਇਹ ਉਹਨਾਂ ਲਈ ਵੀ ਵਧੀਆ ਹੈ ਅਤੇ ਉਹ ਇਕੱਠੇ ਮਿਲ ਕੇ ਇੰਜੋਏ ਵੀ ਕਰਦੇ ਹਨ ਇਸ ਲਈ ਸਾਨੂੰ ਜ਼ਰੂਰੀ ਹੈ ਕਿ ਅਸੀਂ ਡਾਂਸ ਦੇ ਵੱਲ ਵੀ ਧਿਆਨ ਦਈਏ ਡਾਂਸ ਇੱਕ ਇਹੋ ਜਿਹਾ ਨਾਚ ਹੈ ਜਿਹੜਾ ਕਿ ਬੰਦੇ ਨੂੰ ਬਿਲਕੁਲ ਰਿਲੈਕਸ ਕਰ ਦਿੰਦਾ ਹੈ ਉਹਦਾ ਮਾਇੰਡ ਅਤੇ ਇੰਜੋਏ ਕਰਦਾ ਹੈ ਅਤੇ ਮੈਂ ਇਹ ਬਿਲਕੁਲ ਕਹਿਣਾ ਚਾਹੂੰਗੀ ਕਿ ਉਹਦੇ ਵਿੱਚ ਲੋਕਾਂ ਨੂੰ ਵੀ ਇਕੱਠੇ ਲਿਆਉਣ ਦੀ ਸ਼ਕਤੀ ਹੈ ਕਿਉਂਕਿ ਜਦੋਂ ਰਲ ਮਿਲ ਕੇ ਉਹ ਡਾਂਸ ਜਾਂ ਭੰਗੜਾ ਜਾਂ ਗਿੱਧਾ ਕੋਈ ਵੀ ਡਾਂਸ ਕਰਦੇ ਹਨ ਤਾਂ ਉਹ ਇਕੱਠੇ ਹੋ ਕੇ ਕਰਦੇ ਹਨ ਅਤੇ ਇਹ ਕਥਨ ਬਿਲਕੁਲ ਸੱਚ ਹੈ